ਹਾਂਜੀ ਸ਼ੇਅਰ ਮਾਰਕੀਟ ਬਾਰੇ ਥੋੜ੍ਹੀ ਜਾਣਕਾਰੀ ਹੈ ਕਿਉਂਕਿ ਅਕਸਰ ਹੀ ਮੇਰੇ ਹਸਬੈਂਡ ਇਹ ਕੰਮ ਕਰਦੇ ਹੈ ਅਤੇ ਉਹ ਮੈਨੂੰ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਤੁਸੀਂ ਮੇਰੇ ਕੋਲ ਆ ਕੇ ਬੈਠੋ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਕੀ ਹੈ ਠੀਕ ਹੈ ਕਿੱਦਾਂ ਇਹ ਹੁੰਦਾ ਹੈ ਸ਼ੇਅਰ ਮਾਰਕੀਟ 'ਚ ਥੋੜ੍ਹਾ ਡਰ ਲੱਗਦਾ ਹੈ ਕਿਉਂਕਿ ਇੱਦਾਂ ਦੀ ਲਾਈਨ ਹੈਗੀ ਹੈ ਜਿਵੇਂ ਤੁਸੀਂ ਜ਼ਿਆਦਾ ਵੀ ਇਹਦੇ 'ਚ ਪਾ ਸਕਦੇ ਹੋ ਥੋੜ੍ਹਾ ਵੀ ਪਾ ਸਕਦੇ ਹੋ ਠੀਕ ਹੈ ਬਹੁਤ ਵਾਰ ਕਰੋੜਪਤੀ ਵੀ ਹੋ ਜਾਂਦਾ ਹੈ ਇਕਦਮ ਥੱਲੇ ਆ ਗਿਆ ਤਾਂ ਰੋਡਪਤੀ ਵੀ ਹੋ ਜਾਈਦਾ ਠੀਕ ਹੈ ਇਹ ਚੀਜ਼ ਥੋੜ੍ਹਾ ਜਿਹਾ ਇਹ ਤੋਂ ਡਰ ਲੱਗਦਾ ਹੈਗਾ ਪਰ ਉਹ ਫਿਰ ਵੀ ਮੈਨੂੰ ਕਹਿ ਗਏ ਉਹ ਕਰਦੇ ਰਹਿੰਦੇ ਆ ਖੁਦ ਕਹਿੰਦੇ ਮੈਨੂੰ ਵੀ ਤੂੰ ਆ ਕੇ ਮੇਰੇ ਯਾਰ ਮੇਰੇ ਕੋਲ ਬੈਠ ਮੈਂ ਤੈਨੂੰ ਦੱਸਦਾਂ ਕਿ ਚੀਜ਼ ਇਸ 'ਚ ਹੈਗੀ ਆ ਠੀਕ ਹੈ ਕਿੰਨੇ ਪੈਸੇ ਲਗਾਉਣੇ ਹੈ ਥੋੜ੍ਹੇ ਦਿਮਾਗ ਲਗਾਵਾਂਗੇ ਤਾਂ ਜ਼ਰੂਰ ਚੱਲੂਗਾ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਦੇਖ ਕੇ ਕਰਨਾ ਪੈਂਦਾ ਹੈਗਾ ਵੀ ਨਹੀਂ ਕਰਨਾ ਇਹ ਤਾਂ ਹੈ ਨਹੀਂ ਮੀਨਸ ਕੋਈ ਵੀ ਕੰਮ ਹੈ ਆਪਾਂ ਜੇ ਕਰਦੇ ਹਾਂ ਤਾਂ ਹੀ ਆਪਾਂ ਨੂੰ ਪਤਾ ਲੱਗਦਾ ਠੀਕ ਹੈ ਸ਼ੇਅਰ ਮਾਰਕੀਟ ਦੇ ਵਿੱਚ ਇੰਨੇ ਲੋਕ ਕਰੋੜਾਂਪਤੀ ਬਣੇ ਹੈ ਵੀ ਚਲੋ ਠੀਕ ਹੈ ਬਹੁਤ ਜਿਨ੍ਹਾਂ ਨੇ ਆਪਣੇ ਬਿਜਨਸ ਨੂੰ ਇੰਨਾ ਸਟੈਬਿਸ਼ ਕੀਤਾ ਹੈਗਾ ਠੀਕ ਹੈ ਤੋ ਮੈਨੂੰ ਹੁਣ ਇੱਦਾਂ ਹੀ ਸਮਝਾਉਂਦੇ ਰਹਿੰਦੇ ਕਹਿਣਗੇ ਦੇਖ ਤਾਂ ਸਹੀ ਵੀ ਆਹ ਬੰਦਾ ਵੀ ਉਥੋਂ ਸ਼ੇਅਰ ਮਾਰਕੀਟ ਤੋਂ ਬਣਿਆ ਹੈਗਾ ਹੈ ਠੀਕ ਹੈ ਮੈਂ ਕਹਿ ਦਿੰਦੀ ਇਹ ਹਾਂਜੀ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਦੀ ਹਾਂ ਫਿਰ ਵੀ ਮਨ 'ਚ ਥੋੜ੍ਹਾ ਜਿਹਾ ਡਰ ਹੁੰਦਾ ਠੀਕ ਹੈ ਵੀ ਪਤਾ ਨਹੀਂ ਹੋ ਪਾਊਗਾ ਕਿ ਨਹੀਂ ਹੋ ਪਾਊਗਾ ਕਿਉਂਕਿ ਇਹ ਥੋੜ੍ਹਾ ਰਿਸਕੀ ਕੰਮ ਹੈਗਾ ਠੀਕ ਹੈ ਡਿਜੀਟਲ ਐਪਸ ਇਹ ਹੈ ਬਹੁਤ ਵਧੀਆ ਨਿਊਜ਼ ਜਿੱਦਾਂ ਉਹਨਾਂ ਕੋਲ ਵੀ ਹੈਗੀ ਆ ਉਹ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਉਂਦੇ ਆ ਅਪ ਡਾਊਨ ਹੋ ਰਿਹਾ ਦੇਖਦੇ ਹੈ ਠੀਕ ਹੈ ਉਹਦੇ ਵਿੱਚ ਕੀ ਹੈ ਇੱਦਾਂ ਦਾ ਠੀਕ ਹੈ ਕਿਹੜਾ ਸ਼ੇਅਰ ਉੱਪਰ ਚਲਾ ਗਿਆ ਕਿਹੜਾ ਨੀਚੇ ਅਗਰ ਕਈ ਵਾਰ ਨਵੇਂ ਨਵੇਂ ਮੈਨੂੰ ਦਿਖਾਉਂਦੇ ਵੀ ਇਕਦਮ ਕੋਈ ਸ਼ੇਅਰ ਉੱਪਰ ਚਲਾ ਜਾਂਦਾ ਹੈ ਠੀਕ ਹੈ ਉਹਦੇ 'ਚ ਜਲਦੀ ਜਲਦੀ ਪੈਸੇ ਲਗਾਉਂਦੇ ਆ ਵੀ ਹੋਰ ਵੱਧ ਜਾਣ ਠੀਕ ਹੈ ਕਈ ਵਾਰ ਘੱਟ ਵੀ ਜਾਂਦਾ ਹੈਗਾ ਐਪਸ ਦਾ ਬਹੁਤ ਫਾਇਦਾ ਵੀ ਹੈ ਤੁਹਾਨੂੰ ਉਸ ਟਾਈਮ ਪਤਾ ਲੱਗਦਾ ਹੈ ਅਪਡੇਟਸ ਹੁੰਦੀਆਂ ਰਹਿੰਦੀਆਂ ਹਨ ਠੀਕ ਹੈ ਬਹੁਤ ਹੀ ਵਧੀਆ ਹੈ ਨਿਊਜ਼ ਇਹਦਾ ਡਪੈਂਡ ਵੀ ਹੈਗਾ ਬਾਕੀ ਜੇ ਤੁਸੀਂ ਆਪਣੇ ਦਿਮਾਗ ਦੇ ਯੂਜ ਕਰਦੇ ਹੋ ਕੰਮ ਕਰਦੇ ਹੋ ਤਾਂ ਬਹੁਤ ਵਧੀਆ ਤੁਹਾਡੇ ਲਈ ਇਨ ਫਿਊਚਰ ਵੀ ਬਹੁਤ ਵਧੀਆ ਹੈ